ਮੈਂ ਬਾਗਬਾਨੀ ਇੱਕ ਸ਼ੌਕ ਵਜੋਂ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਅਸੀਂ ਫੁੱਲ ਪੌਦੇ ਲਾਏ ਹੋਏ ਸਨ ਅਤੇ ਅਸੀਂ ਉਹਨਾਂ ਨੂੰ ਸ਼ੌਕ ਵਜੋਂ ਲਾਇਆ ਹੋਇਆ ਹੈ ਅਤੇ ਹੌਲੀ ਹੌਲੀ ਉਹਨਾਂ ਨੂੰ ਅਸੀਂ ਵਧਾ ਦਿੱਤਾ ਅਤੇ ਉਹਨਾਂ ਨੂੰ ਸ਼ੌਕ ਵਜੋਂ ਉਹ ਵਧਾਉਣ ਕਾਰਨ ਉਹ ਬਹੁਤ ਸੋਹਣਾ ਬਣ ਗਿਆ ਉਹਨਾਂ ਨੂੰ ਦੇਖ ਕੇ ਹੋਰ ਵੀ ਆਂਢੀ ਗਵਾਂਢੀ ਦੇਖਣ ਆਏ ਅਤੇ ਉਹਨਾਂ ਨੇ ਵੀ ਇਹ ਇਹਨਾਂ ਨੂੰ ਦੇਖ ਕੇ ਆਪਣੇ ਘਰ ਵਿੱਚ ਵੀ ਸ਼ੁਰੂ ਕੀਤਾ ਇਹ ਇਹ ਬਾਗਬਾਨੀ ਅਸੀਂ ਇੱਕ ਹਰਿਆਲੀ ਸ਼ੌਕ ਵਜੋਂ ਅਤੇ ਆਪਣਾ ਪੰਜਾਬੀ ਵਿਰਸੇ ਵਾਸਤੇ ਵਧੀਆ ਆਪਣਾ ਬਣਾ ਰਹੇ ਹਾਂ ਅਤੇ ਇਹ ਆਕਸੀਜਨ ਛੱਡਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਆਪਣੇ ਬਾਗ ਬਗੀਚੇ ਨੂੰ ਅਸੀਂ ਸਾਫ ਸੁਥਰਾ ਰੱਖਦੇ ਹਾਂ ਅਤੇ ਇਹਦੇ ਵਿੱਚ ਬੈਠ ਕੇ ਦਸ ਮਿੰਟ ਆਪਣਾ ਮਨੋਰੰਜਨ ਵੀ ਕਰਦੇ ਹਾਂ ਅਤੇ ਇਹ ਸਾਨੂੰ ਬਹੁਤ ਬਹੁਤ ਵਧੀਆ ਲੱਗਦੀ ਹੈ ਅਤੇ ਬਾਗਬਾਨੀ ਲਈ ਸ਼ੌਕ ਇੱਕ ਸਾਡੇ ਲਈ ਹੈ